ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੈਂ ਕੁਝ ਦਿਨ ਪਹਿਲਾਂ ਤੁਹਾਡੀ ਕੰਪਨੀ 'ਚੋਂ ਇੱਕ ਪ੍ਰੋਡਕਟ ਔਡਰ ਕੀਤਾ ਸੀ ਜੋ ਕਿ ਬਹੁਤ ਹੀ ਜ਼ਿਆਦਾ ਮਾੜਾ ਨਿਕਲਿਆ ਮੈਨੂੰ ਤੁਹਾਡੀ ਕੰਪਨੀ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਅਤੇ ਜਦੋਂ ਔਡਰ ਮੇਰੇ ਕੋਲ ਆਇਆ ਇੱਕ ਤਾਂ ਉਸਦੀ ਪੈਕਿੰਗ ਵੀ ਵਧੀਆ ਨਹੀਂ ਸੀ ਗ਼ਲਤ ਢੰਗ ਨਾਲ਼ ਪੈਕ ਕੀਤਾ ਹੋਇਆ ਸੀ ਅਤੇ ਇੱਕ ਤਾਂ ਮੈਂ ਐਨੇ ਪੈਸੇ ਵੀ ਲਗਾਏ ਉਸ ਪ੍ਰੋਡਕਟ 'ਤੇ ਪਰ ਪ੍ਰੋਡਕਟ ਬਹੁਤ ਹੀ ਮਾੜਾ ਨਿਕਲ਼ਿਆ ਹੁਣ ਜਦੋਂ ਕੋਈ ਮੇਰਾ ਯਾਰ ਮਿੱਤਰ ਅਤੇ ਮੇਰੇ ਪਰਿਵਾਰ ਦਾ ਬੰਦਾ ਉਸ ਪ੍ਰੋਡਕਟ ਨੂੰ ਲੈਣ ਲਈ ਕਹੇਗਾ ਮੈਂ ਸਾਫ਼ ਹੀ ਮਨ੍ਹਾ ਕਰ ਦੇਵਾਂਗਾ ਕਿਉਂਕਿ ਉਹ ਪ੍ਰੋਡਕਟ ਵਧੀਆ ਨਹੀਂ ਸੀ